ਗੁੱਡ ਮੋਰਨਿੰਗ ਮੈਮ ਮੈਮ ਤੁਸੀਂ ਜਿਹੜਾ ਹੈਗਾ ਆਪਣੇ ਸਕੂਲ ਦੇ ਵੱਲੋਂ ਇੱਕ ਐਡਵਰਟੈਜ਼ਮੈਂਟ ਦਿੱਤੀ ਸੀ ਜਿਹਦੇ ਵਿੱਚ ਤੁਹਾਨੂੰ ਪੋਲ ਸਾਇੰਸ ਦੇ ਟੀਚਰ ਦੀ ਜ਼ਰੂਰਤ ਸੀ ਅਤੇ ਮੈਨੂੰ ਲੱਗਦਾ ਕਿ ਮੈਂ ਉਹਦੀ ਕੁਆਲੀਫਿਕੇਸ਼ਨਸ ਲਈ ਬਹੁਤ ਇਲੀਜ਼ੀਬਲ ਹਾਂ ਅਤੇ ਪਲੀਜ਼ ਮੈਨੂੰ ਇੰਟਰਵਿਊ ਲਈ ਕਿਹਾ ਗਿਆ ਸੀ ਮੈਂ ਪਹਿਲਾਂ ਕੋਲ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਇੰਟਰਵਿਊ ਲੈ ਲਊਂਗੇ ਤੁਹਾਡਾ ਅਤੇ ਮੈਂ ਤਾਂ ਹੀ ਤੁਹਾਨੂੰ ਕੋਲ ਕੀਤੀ ਹੈ

ਹਾਂਜੀ ਮੈਮ ਮੈਂ ਆਪਣੀ ਜਿਹੜੀ ਮਾਸਟਰ ਡਿਗਰੀ ਅਤੇ ਬੈਚਲਰ ਡਿਗਰੀ ਹੈ ਉਹ ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਈ ਹੈ ਦੋਨੇ ਦੋਵੇਂ ਹੀ ਅਤੇ ਮੈਨੂੰ ਇੱਕ ਸਾਲ ਦਾ ਐਕਸਪੀਰੀਅੰਸ ਹੈ ਜਿਹਦੇ ਨਾਲ ਸਕੂਲ ਦੇ ਵਿੱਚ ਐਜ਼ ਆ ਪੋਲ ਸਾਇੰਸ ਟੀਚਰ ਪੜ੍ਹਾਇਆ ਹੋਇਆ ਹੈ ਅਤੇ ਉਹਦੇ ਨਾਲ ਨਾਲ ਮੈਂ ਇੱਕ ਡਿਪਲੋਮਾ ਵੀ ਕੀਤਾ ਹੈ ਜਿਹੜਾ ਕਿ ਸਾਡੇ ਕੋਲੇਜ ਦੇ ਵਿੱਚ ਹੀ ਕਰਾਇਆ ਗਿਆ ਸੀ ਮੇਰੀ ਡਿਗਰੀ ਦੇ ਨਾਲ ਨਾਲ ਉਹਦੇ ਵਿੱਚ ਮੈਮ ਆਪਾਂ ਨੂੰ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਬਾਰੇ ਬੜੀ ਚੰਗੀ ਤਰ੍ਹਾਂ ਦੱਸਿਆ ਗਿਆ ਹਾਂਜੀ ਹਾਂਜੀ ਮੈਮ ਜਿਹੜੇ ਪ੍ਰੈਜੀਡੈਂਟ ਇਲੈਕਸ਼ਨ ਨੇ ਉਹ ਸੀਕਰੇਟ ਬੈਲਰ ਦੇ ਥਰੂ ਹੁੰਦੇ ਨੇ ਜਿਹਦੇ ਵਿੱਚ ਜਿਹੜੇ ਕੈਂਡੀਡੇਟਸ ਹੁੰਦੇ ਨੇ ਇਲੈਕਸ਼ਨ ਪ੍ਰੈਜੀਡੈਂਟ ਦੇ ਪ੍ਰੈਜੀਡੈਂਟ ਦੀ ਪੋਸਟ ਲਈ ਉਹਨਾਂ ਨੇ ਜਿਹੜਾ ਹੈਗਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕੀ ਉਹ ਫਸਟ 'ਤੇ ਹੈ ਸੈਕਿੰਡ 'ਤੇ ਹੈ ਥਰਡ 'ਤੇ ਹੈ ਮੈਮ ਗਵਰਨਰ ਦੀਆਂ ਜਿਹੜੀ ਪਾਵਰਸ ਨੇ ਜਿਵੇਂ ਹੁਣ ਸੈਂਟਰ ਸੈਂਟਰ ਨੂੰ ਰਿਪੋਰਟ ਕਰਨਾ ਕਿ ਸਟੇਟ ਦੀ ਫੰਕਸ਼ਨਿੰਗ ਕਿਵੇਂ ਹੋ ਰਹੀ ਹੈ ਅਤੇ ਫੰ ਇਹਦੇ ਵਿੱਚ ਕੋਂਸਟੀਟਿਊਸ਼ਨ ਰੂਲਸ ਦੇ ਅਕੋਰਡਿੰਗ ਫੰਕਸ਼ਨਿੰਗ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਉਹ ਦੇਖਣਾ ਅਤੇ ਸੀ ਐਮ ਰਿਪੋਰਟ ਪੁੱਛਣਾ ਕਿ ਉਹ ਸਟੇਟ ਦੇ ਵਿੱਚ ਕੀ ਕੀ ਹੋ ਰਿਹਾ ਓਕੇ ਮੈਮ ਥੈਂਕ ਯੂ ਮੈਮ ਥੈਂਕ ਯੂ